ਸਾਡੇ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਲਈ ਜਿਹੜਾ ਵਾ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਕੀ ਹੈ ਇੱਕ ਪੇਂਡੂ ਖ ਖੇਤਰ ਹੋਣ ਦੇ ਕਾਰਨ ਜਿਹੜਾ ਵਾ ਉਹਨਾਂ ਦੀ ਰੋਜ਼ ਦੀ ਜ਼ਿੰਦਗੀ 'ਤੇ ਬਹੁਤ ਹੀ ਅਸਰ ਪਾ ਰਿਹਾ ਹੈ ਕਿਉਂਕਿ ਇੱਥੇ ਜਿਹੜਾ ਵਾ ਰੋਜ਼ ਦੀ ਰੋਜ਼ ਜਿਹੜੀ ਦੁਨੀਆ ਤਾਂ ਵੱਧਦੀ ਜਾ ਰਹੀ ਹੈ ਅਤੇ ਨੌਕਰੀਆਂ ਜਿਹੜੀਆਂ ਇਸ ਖੇਤਰ ਦੇ ਵਿੱਚ ਘਟਦੀਆਂ ਜਾ ਰਹੀਆਂ ਨੇ ਜਿਹੜੇ ਲੋਕ ਆ ਉਹ ਚੰਗੀ ਤਰ੍ਹਾਂ ਕੀ ਐਜੂਕੇਟਡ ਨਹੀਂ ਹੋ ਪਾ ਰਹੇ ਕਿਉਂਕਿ ਫੈਸਿਲਿਟੀ ਜਿਹੜੀ ਇੰਨੀ ਗਵਰਮੈਂਟ ਵੱਲੋਂ ਜਿਹੜੀ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਸਰਕਾਰ ਵੱਲੋਂ ਕਿ ਤਾਂ ਕਿ ਜਿਹੜੇ ਨੌਜਵਾਨ ਆ ਪਿੰਡਾਂ ਦੇ ਉਹ ਜਿਹੜੇ ਆਪਣੀ ਜਿਹੜੀ ਪੜ੍ਹਾਈ ਉੱਚ ਪੱਧਰ 'ਤੇ ਜਾ ਕੇ ਕਰ ਸਕਣ ਕੁਝ ਕੀ ਆ ਆਰਥਿਕ ਪੱਖ ਤੋਂ ਜਿਹੜੇ ਆ ਉਹ ਘੱਟ ਨੇ ਅਤੇ ਕੁਝ ਜਿਹੜੇ ਆ ਉਹਨਾਂ ਨੂੰ ਆਉਣ ਜਾਣ ਦੀ ਜਿਹੜੀ ਆ ਪ੍ਰੇਸ਼ਾਨੀ ਦੇ ਕਾਰਨ ਜਿਹੜੀ ਉਹ ਐਜੂਕੇਸ਼ਨ ਜਿਹੜੀ ਨਹੀਂ ਲੈ ਪਾਉਂਦੇ ਇਹਦੇ ਨਾਲ ਕੀ ਆ ਉਹ ਕੀ ਆ ਜਿਹੜੀ ਕੁਐਲੀਫਿਕੇਸ਼ਨ ਜਿਹੜੀ ਮੰਗਦੇ ਨੇ ਨੌਕਰੀਆਂ ਦੇ ਲਈ ਜਿਹੜੀ ਵੀ ਫੈਕਟਰੀਸ ਦੇ ਲਈ ਜਾਂ ਕਿਸੇ ਹੋਰ ਬਿਜਨਸ ਦੇ ਲਈ ਉਹਨਾਂ ਦੀ ਕੀ ਹੈ ਕੁਐਲੀਫਿਕੇਸ਼ਨ ਜਿਹੜੀ ਪੂਰੀ ਨਹੀਂ ਕਰ ਪਾਉਂਦੇ ਇਹਦੇ ਨਾਲ ਕੀ ਆ ਨੌਕਰੀਆਂ ਦੇ ਜਿਹੜੇ ਚਾਂਸਿਸ ਆ ਉਹ ਜਿਹੜੇ ਘੱਟ ਜਾਂਦੇ ਨੇ ਉਲਟਾ ਇਹ ਹੁੰਦਾ ਆ ਕਿ ਬਾਹਰੋਂ ਜਿਹੜੀ ਆ ਦੂਜੇ ਦੇਸ਼ਾਂ ਤੋਂ ਜਿਹੜੇ ਲੋਕ ਆਉਂਦੇ ਨੇ ਉੱਧਰ ਦੇ ਨੌਜਵਾਨਾਂ ਨੂੰ ਜਿਹੜਾ ਆ ਇੱਧਰ ਰੁਜ਼ਗਾਰ ਮਿਲ ਜਾਂਦਾ ਹੈ ਕਿਉਂਕਿ ਉੱਧਰ ਜਿਹੜੀਆਂ ਕੰਟਰੀਜ਼ ਹੈਗੀਆਂ ਨੇ ਜਿਹੜੇ ਦੇਸ਼ ਨੇ ਉਹ ਜ਼ਿਆਦਾ ਡਿਵੈਲਪ ਡਿਵੈਲਪਡ ਹੈਗੇ ਨੇ ਇੱਧਰ ਦੇ ਨਾਲੋਂ ਇਸ ਨਾਲ ਕੀ ਹੁੰਦਾ ਕਿ ਜਿਹੜੇ ਆਪਣੇ ਪਿੰ ਜਿਹੜੇ ਇੱਧਰ ਦੇ ਲੋਕ ਨੇ ਉਹ ਬਾਹਰ ਜਾਣ ਦੇ ਜ਼ਿਆਦਾ ਚਾਹਵਾਨ ਹੈ ਇਥੋਂ ਜਿਹੜੇ ਲੋਕ ਨੌਜਵਾਨ ਆ ਉਹ ਕੀ ਬਾਹਰ ਜਾਣ ਦਾ ਜ਼ਿਆਦਾ ਸੋਚਦੇ ਨੇ ਅਤੇ ਬਾਹਰ ਜਾਣ ਵਿੱਚ ਕੀ ਆ ਸਾਰਾ ਟਾਈਮ ਜਿਹੜਾ ਵੇਸਟ ਕਰ ਦਿੰਦੇ ਆ ਨੌਕਰੀਆਂ ਜਿਹੜੀਆਂ ਘੱਟ ਅਪਲਾਈ ਕਰਦੇ ਨੇ ਇਹਦੇ ਨਾਲ ਕੀ ਆਪਣੇ ਜਿਹੜੇ ਇੱਧਰ ਦੇ ਨੌਜਵਾਨ ਆ ਉਹ ਸਾਰੇ ਬਾਹਰ ਜਾ ਰਹੇ ਨੇ